ਨੌਂ ਅਕਤੂਬਰ ਦੋ ਜੀਰੋ ਜੀਰੋ ਦੋ ਸੱਤ ਦਸੰਬਰ ਦੋ ਜੀਰੋ ਜੀਰੋ ਅੱਠ ਸ ਇੱਕ ਸੱਤ ਮਈ ਦੋ ਜੀਰੋ ਜੀਰੋ ਚਾਰ ਚਾਰ ਜਨਵਰੀ ਦੋ ਜੀਰੋ ਜੀਰੋ ਸੱਤ ਇੱਕ ਦਸ ਜੂਨ ਦੋ ਜੀਰੋ ਜੀਰੋ ਦੋ ਚਾਰ